ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਅਤੇ ਸਾਨੂੰ ਘੁੰਮਣ ਫਿਰਨ ਲਈ ਗੱਡੀਆਂ ਚਾਹੀਦੀਆਂ ਹਨ ਸਾਡੇ ਨਾਲ ਟੋਟਲ ਚਾਰ ਪਰਿਵਾਰ ਹਨ ਜਿਹਦੇ ਵਿੱਚ ਦੋ ਵੱਡੇ ਲੋਕ ਅਤੇ ਦੋ ਬੱਚੇ ਹਨ ਟੋਟਲ ਚਾਰ ਫੈਮਿਲੀਆਂ ਹਨ ਅਤੇ ਅਸੀਂ ਸ਼ਿਮਲਾ ਕੁਫਰੀ ਜਾਣ ਦਾ ਪਲੈਨ ਕੀਤਾ ਹੈ ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਸ ਹਿਸਾਬ ਨਾਲ ਚਾਰਜ ਲਵੋਗੇ ਪ੍ਰਤੀ ਕਿਲੋਮੀਟਰ ਅਤੇ ਰਹਿਣ ਸਹਿਣ ਤੁਹਾਡਾ ਖਾਣ ਪੀਣ ਜੋ ਵੀ ਹੋਵੇਗਾ ਸਾਨੂੰ ਟੋਟਲ ਦਸ ਦਿਨਾਂ ਲਈ ਗੱਡੀਆਂ ਚਾਹੀਦੀਆਂ ਹਨ ਤਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਟੋਟਲ ਚਾਰ ਪਰਿਵਾਰ ਹਨ ਅਤੇ ਤੁਸੀਂ ਆਪਣੇ ਹਿਸਾਬ ਨਾਲ ਦੱਸੋ ਕਿ ਸਾਨੂੰ ਗੱਡੀਆਂ ਕਰਨੀਆਂ ਚਾਹੀਦੀਆਂ ਹਨ ਕਿ ਇੱਕ ਟੂਰਿਸਟ ਬੱਸ ਉਹ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਕੀ ਪ੍ਰੈਫਰ ਕਰਦੇ ਹੋ ਜ਼ਿਆਦਾ ਜੇ ਤੁਸੀਂ ਗੱਡੀਆਂ ਪ੍ਰੈਫਰ ਕਰਦੇ ਹੋ ਤਾਂ ਟੋਟਲ ਚਾਰ ਗੱਡੀਆਂ ਲੱਗਣਗੀਆਂ ਅਤੇ ਜੇ ਤੁਸੀਂ ਬਸ ਪ੍ਰੈਫਰ ਕਰਦੇ ਹੋ ਤਾਂ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਚਾਰ ਫੈਮਲੀਆਂ ਹਨ ਅਤੇ ਦੋ ਦੋ ਬੱਸਾਂ ਹੋ ਜਾਣਗੀਆਂ ਅਤੇ ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਉਹਦੇ ਬਾਰੇ ਉਹਦੇ ਚਾਰਜਿਸ ਅਤੇ ਉਹਦੀ ਫੀਸ ਵਗੈਰਾ ਕੀ ਹੋਵੇਗੀ ਸਾਨੂੰ ਟੋਟਲ ਦੱਸ ਦਿਨਾਂ ਲਈ ਚਾਹੀਦੀਆਂ ਹਨ ਗੱਡੀਆਂ ਅਤੇ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਰਹਿਣ ਸਹਿਣ ਦਾ ਕੀ ਚਾਰਜਿਸ ਹੈ ਅਤੇ ਕੀ ਉਸ ਚੀਜ਼ 'ਤੇ ਵੋ ਅ ਕਿਲੋਮੀਟਰ ਵਗੈਰਾ ਹਨ ਕਿ ਤੁਸੀਂ ਕਿਸ ਬੇਸਿਸ ਦੇ ਉੱਤੇ ਸਾਨੂੰ ਗੱਡੀ ਦਿਓਗੇ ਅਤੇ ਕੀ ਚਾਰਜਿਸ ਹਨ ਉਹਦੇ